ਸਤਿ ਸ਼੍ਰੀ ਅਕਾਲ ਜੀ ਜੀ ਮੈਂ ਪ੍ਰੈਸ ਮੀਡੀਆ ਤੋਂ ਆਈ ਆਂ ਤੇ ਮੈਂ ਤੁਹਾਡੇ ਤੋਂ ਪੁੱਛਣਾ ਸੀਗਾ ਕਿ ਹੁਸ਼ਿਆਰਪੁਰ ਦੇ ਵਿੱਚ ਕੀ ਕੀ ਵਿਕਾਸ ਹੋਇਆ ਆ ਅੱਜ ਤੱਕ

ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਕੀ ਤੁਸੀਂ ਕੋਲਜ ਦੇ ਅੱਛਾ ਜੀ ਅੱਛਾ ਜੀ ਅੱਛਾ ਜੀ ਤੁਸੀਂ ਦੱਸ ਸਕਦੇ ਹੋ ਕਿ ਹੁਸ਼ਿਆਰਪੁਰ ਦੇ ਵਿੱਚ ਸਾਫ ਸਫਾਈ ਦਾ ਕੀ ਮਾਹੌਲ ਹੈ ਰਹਿਣ ਵਸੇਰਾ ਕਿਵੇ ਕਰਦੇ ਅੱਛਾ ਜੀ ਤੇ ਤੁਸੀਂ ਦੱਸ ਸਕਦੇ ਹੋ ਕਿ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਿਵੇਂ ਦਾ ਕੰਮ ਕਰ ਰਹੀ ਹੈ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਦੇ ਲਈ ਠੀਕ ਹੈ ਜੀ